ਸਾਡੇ ਪਿੰਡ ਵਿੱਚ ਜਦੋਂ ਕਿਸੇ ਦੇ ਕੋਈ ਕੀੜਾ ਮਕੌੜਾ ਡੰਕ ਮਾਰਦਾ ਜਾਂ ਫਿਰ ਮਧੂਮੱਖੀ ਡੰਕ ਮਾਰਦੀ ਹੈ ਤਾਂ ਉਸਨੂੰ ਘਰੇਲੂ ਉਪਚਾਰ ਨਾਲ ਠੀਕ ਕਰਨ ਲਈ ਇੱਕ ਤਾਂ ਲੋਹੇ ਦੀ ਕੋਈ ਚੀਜ਼ ਜਿਵੇਂ ਕਿ ਆਪਾਂ ਹੱਥ 'ਚ ਕੜਾ ਪਾਉਨੇ ਹੈ ਉਹਨੂੰ ਉਸ 'ਤੇ ਰਗੜਿਆ ਜਾਂਦਾ ਜਿੱਥੇ ਡੰਕ ਮਾਰਿਆ ਹੁੰਦਾ ਜਾਂ ਫਿਰ ਆਲੂ ਨੂੰ ਕੱਟ ਕੇ ਆਲੂ ਨੂੰ ਰਗੜਿਆ ਜਾਂਦਾ ਉਸ ਦੇ ਉੱਤੇ ਜਾਂ ਫਿਰ ਉਹਦੇ ਲਈ ਪੇਸਟ ਉੱਪਰ ਲਾਇਆ ਜਾਂਦਾ ਹੈ ਜੋ ਆਪਾਂ ਦੰਦਾਂ ਨੂੰ ਸਾਫ਼ ਕਰਨ ਲਈ ਵਰਤਦੇ ਹੈ ਇਹ ਸਭ ਚੀਜ਼ਾਂ ਘਰੇਲੂ ਹੀ ਹਨ ਜਿਨਾਂ ਨੂੰ ਆਪਾਂ ਵਰਤ ਸਕਦੇ ਹਾਂ ਡੰਕ ਨੂੰ ਠੀਕ ਕਰਨ ਲਈ